ਰਾਜ ਵਿੱਚ ਬਹੁਤ ਸਾਰੇ ਮੁੱਖ ਧਾਰਮਿਕ ਸਥਾਨ ਹਨ ਜਿਵੇਂ ਕਿ ਮੰਦਰ ਮਸਜਿਦ ਗੁਰਦੁਆਰਾ ਚਰਚ ਆਦਿ ਮੇਰੇ ਇਹ ਪਿੰਡ ਦੇ ਨੇੜੇ ਹੀ ਇੱਕ ਗੁਰਦੁਆਰਾ ਹੈ ਜਿਸ ਦਾ ਨਾਮ ਕਿਲ੍ਹਾ ਮੁਬਾਰਕ ਹੈ ਇਹ ਇੱਕ ਸਿੱਖ ਇਤਿਹਾਸਿਕ ਗੁਰਦੁਆਰਾ ਹੈ ਇਸਦੇ ਮੈਂ ਮਹੀਨੇ ਵਿੱਚ ਦੋ ਜਾਂ ਤਿੰਨ ਵਾਰ ਆਪਣੀ ਫੈਮਿਲੀ ਦੇ ਨਾਲ ਜਾਂਦੀ ਹਾਂ ਇੱਥੇ ਜਾ ਕੇ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਦਾ ਹੈ ਕਿਉਂਕਿ ਇਹ ਕਿਲ੍ਹਾ ਮੁਬਾਰਕ ਵਿੱਚ ਇੱਕ ਗੁਰਦੁਆਰਾ ਵੀ ਸਥਿੱਤ ਹੈ ਜਿੱਥੇ ਕਿ ਹਮੇਸ਼ਾ ਕੀਰਤਨ ਚੱਲਦਾ ਰਹਿੰਦਾ ਹੈ ਇੱਥੇ ਜਾ ਕੇ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਬਲਕਿ ਮੇਰੇ ਘਰ ਦੇ ਨੇੜੇ ਹੀ ਇੱਕ ਗੁਰਦੁਆਰਾ ਸਥਿੱਤ ਹੈ ਜਿੱਥੇ ਕਿ ਮੈਂ ਹਰ ਰੋਜ਼ ਜਾਂਦੀ ਹਾਂ ਅਤੇ ਮੈਂ ਇਹ ਕੋਸ਼ਿਸ਼ ਕਰਦੀ ਹਾਂ ਕਿ ਮੈਂ ਹਰ ਰੋਜ਼ ਸ਼ਾਮ ਨੂੰ ਜਾ ਕੇ ਉੱਥੇ ਰਹਿਰਾਸ ਦਾ ਪਾਠ ਕਰਾਂ ਜਿਹੜਾ ਕਿ ਮੈਨੂੰ ਬਹੁਤ ਜ਼ਿਆਦਾ ਸ਼ਾਂਤੀ ਦਿੰਦਾ ਹੈ ਜਦੋਂ ਵੀ ਮੈਂ ਘਰਦਿਆਂ ਨਾਲ ਲੜ ਕੇ ਜਾਂ ਗੁੱਸੇ ਹੋ ਕੇ ਘਰੋਂ ਜਾਂਦੀ ਹਾਂ ਤਾਂ ਮੈਂ ਹਮੇਸ਼ਾ ਗੁਰਦੁਆਰੇ ਜਾ ਕੇ ਝਾੜੂ ਲਗਾ ਆਦਿ ਲਗਾ ਕੇ ਸੇਵਾ ਕਰਦੀ ਹਾਂ ਜਿਹੜਾ ਕਿ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਦਿੰਦਾ ਹੈ ਅਜਿਹਾ ਕਰਨ ਨਾਲ ਮੈਨੂੰ ਬਹੁਤ ਜ਼ਿਆਦਾ ਸ਼ਾਂਤੀ ਵੀ ਮਿਲਦੀ ਹੈ ਧੰਨਵਾਦ